ਹਰ ਇੱਕ ਵਿਅਕਤੀ ਵਿਅਕਤੀ ਗਾਣਾ ਨਹੀਂ ਗਾ ਸਕਦਾ ਗਾਣਾ ਗਾਉਣ ਲਈ ਆਵਾਜ਼ ਸੁਰੀਲੀ ਹੋਣੀ ਚਾਹੀਦੀ ਹੈ ਅਤੇ ਸਾਫ਼ ਸੁਥਰੀ ਆਵਾਜ਼ ਹੋਣੀ ਚਾਹੀਦੀ ਹੈ ਗਲ ਵਿੱਚ ਕੋਈ ਖਰਾਬੀ ਨਹੀਂ ਹੋਣੀ ਚਾਹੀਦੀ ਅਤੇ ਵਧੀਆ ਗਾਣਾ ਗਾਉਣ ਲਈ ਕਿਸੇ ਦੀ ਕਿਸੇ ਗੁਰੂ ਨੂੰ ਧਾਰਨ ਕਰਨਾ ਚਾਹੀਦਾ ਹੈ ਜਾਂ ਆਪਣੇ ਕੋਈ ਦੋਸਤ ਮਿੱਤਰ ਜਾਂ ਕੋਈ ਕਲਾਕਾਰ ਉਸਦੀ ਉਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਜੇ ਓ ਜੇ ਕੋਈ ਗਲਤੀ ਹੋਵੇ ਤਾਂ ਉਹ ਤੁਹਾਡੀ ਗਲਤੀ ਨੂੰ ਸੁਧਾਰੇਗਾ ਔਰ ਉਸ ਉਹ ਤੁਹਾਨੂੰ ਦੱਸੇਗਾ ਵੀ ਕਿਸ ਤਰ੍ਹਾਂ ਤੁਸੀਂ ਗਾਉਣਾ ਵਾ ਕਿਸ ਤਰ੍ਹਾਂ ਆਵਾਜ਼ ਕੱਢਣੀ ਹੈ ਸੁਰੀਲੀ ਆਵਾਜ਼ ਕਿਵੇਂ ਨਿਕਲੇਗੀ ਤੁਹਾਡੀ ਹੈ ਨਾ ਵੀ ਗਲਤੀ ਦੀ ਤੁਹਾਡੀ ਗਲਤੀ ਸੁਧਾਰੇਗਾ ਉਹ ਜੋ ਵੀ ਤੁਸੀਂ ਗਲਤੀ ਕਰੋਂਗੇ ਇਸ ਕਰਕੇ ਗਲ ਸਾਫ਼ ਰੱਖਣ ਵਾਸਤੇ ਅਤੇ ਆਪਾਂ ਨੂੰ ਕੋਈ ਠੰਡਾ ਪਾਣੀ ਵਗੈਰਾ ਕੋਈ ਖੱਟੀ ਚੀਜ਼ ਨਹੀਂ ਖਾਣੀ ਚਾਹੀਦੀ ਇਸ ਨਾਲ ਆਪਣੀ ਆਵਾਜ਼ ਨੂੰ ਪ੍ਰੋਬਲਮ ਹੋ ਜਾਂਦੀ ਹੈ ਹੈ ਨਾ ਆਵਾਜ਼ ਖਰਾਬ ਹੋਣ ਲੱਗ ਜਾਂਦੀ ਹੈ ਅਤੇ ਸਹੀ ਗਾਣਾ ਨਹੀਂ ਗਾਇਆ ਜਾਂਦਾ ਸਹੀ ਗਾਣਾ ਗਾਉਣ ਲਈ ਆਵਾਜ਼ ਨੂੰ ਆਵਾਜ਼ ਸਾਫ਼ ਸੁਥਰੀ ਅਤੇ ਸੁਰੀਲੀ ਆਵਾਜ਼ ਹੋਣੀ ਚਾਹੀਦੀ ਹੈ ਕੋਈ ਵੀ

ਕੋ ਕੋਈ ਵੀ ਗਲਤੀ ਹੋਵੇ ਤਾਂ ਆਪਾਂ ਨੂੰ ਆਪਣਾ ਗੁਰੂ ਸਮਝਾ ਸਮਝਾਊਗਾ ਉਸ ਤਰ੍ਹਾਂ ਹੀ ਆਪਾਂ ਗਾਉਣਾ ਹੈ